ਸ਼ਹੀਦ ਭਗਤ ਸਿੰਘ ਦੇ ਆਜ਼ਾਦੀ ਦੇ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਬਹੁਤ ਮਹੱਤਵਪੂਰਨ ਸੀ ਉਹ ਅਠਾਈ ਸਾਲਾਂ ਦੀ ਉਮਰ ਵਿੱਚ ਸਿੰਘਾਂ ਅਤੇ ਹੋਰ ਵਿਰੋਧੀਆਂ ਲਈ ਪ੍ਰੇਰਨਾ ਦਾ ਸਾਧਨ ਬਣੇ ਜੀਵਨੀ ਅਤੇ ਪ੍ਰੇਰਨਾ ਭਗਤ ਸਿੰਘ ਦਾ ਜਨਮ ਉੱਨੀ ਸੌ ਸੱਤ ਈਸਵੀ ਵਿੱਚ ਪੰਜਾਬ ਦੇ ਬੰਗੀ ਖਾਨਦਾਨ ਵਿੱਚ ਹੋਇਆ ਉਹਨਾਂ ਦੀਆਂ ਸੋਚਾਂ ਅਤੇ ਰਾਸ਼ਟਰਵਾਦ ਅਤੇ ਸਮਾਜਵਾਦ ਦੇ ਆਸਰੇ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਬ੍ਰਿਸ਼ਟ ਰਾਜ ਖਿਲਾਫ ਵਿਰੋਧੀ ਚੀਜ਼ਾਂ ਦਾ ਸਾਹਮਣਾ ਕੀਤਾ ਉਹ ਲਾਹੌਰ ਵਿਖੇ ਗਦਰ ਪਾਰਟੀ ਅਤੇ ਫਿਰ ਹਿੰਦੁਸਤਾਨ ਸੋਕੀਲਿਸਟ ਰਿਪਬਲਿਕ ਐਸੋਏਸ਼ਨ ਨਾਲ ਜੁੜ ਗਏ ਇਹਨਾਂ ਸੰਗਠਨਾਂ ਨੇ ਬ੍ਰਿਸ਼ਟ ਹਕੂਮਤ ਖਿਲਾਫ਼ ਹਮਲਿਆਂ ਦੀ ਯੋਜਨਾ ਬਣਾਈ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਉੱਨੀ ਸੌ ਅਠਾਈ ਵਿੱਚ ਸਿਟੀ ਪੁਲਿਸ ਦੇ ਅਧਿਕਾਰੀ ਜੇ ਐਸ ਸਿੰਘ ਦੇ ਵਿਰੁੱਧ ਹਮਲਾ ਕੀਤਾ ਇਸ ਦੇ ਬਾਅਦ ਉਹਨਾਂ ਨੇ ਲਾਹੌਰ ਵਿਖੇ ਬੀ ਐਸ ਬੀ ਐਲ ਰਾਏ ਦੇ ਮਾਰਨ ਦੀ ਯੋਜਨਾ ਬਣਾਈ ਸੀ ਪਰ ਗਲਤੀ ਨਾਲ ਉਹਨਾਂ ਨੇ ਕੁਝ ਹੋਰ ਲੋਕਾਂ ਨੂੰ ਬਰਬਾਦ ਕੀਤਾ ਉਹ ਆਪਣੇ ਲਿਖਾੜੀ ਅਤੇ ਲਿਖਾਰੀ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਮਦਦਗਾਰ ਸਾਬਤ ਹੋਏ ਉਹਨਾਂ ਨੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਦਿੱਤਾ ਜੋ ਆਜ਼ਾਦੀ ਸੰਗਰਾਮ ਦਾ ਪ੍ਰਤੀਕ ਬਣ ਗਿਆ ਭਗਤ ਸਿੰਘ ਨੂੰ ਉੱਨੀ ਸੌ ਇਕੱਤੀ ਵਿੱਚ ਫਾਂਸੀ ਦਿੱਤੀ ਗਈ ਪਰ ਉਹਨਾਂ ਦੀ ਸ਼ਹਾਦਤ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਨਵਾਂ ਜੋਸ਼ ਦਿੱਤਾ ਉਹ ਇੱਕ ਪ੍ਰਤੀਕ ਬਣ ਗਏ ਜੋ ਭਾਰਤੀ ਲੋਕਾਂ ਨੂੰ ਬ੍ਰਿਸ਼ਟ ਰਾਜ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੰਦਾ ਹੈ ਭਗਤ ਸਿੰਘ ਦੇ ਯੋਗਦਾਨ ਨੂੰ ਸਦਾ ਯਾਦ ਕੀਤਾ ਜਾਂਦਾ ਹੈ ਅਤੇ ਉਹ ਆਜ਼ਾਦੀ ਦੀ ਲੜਾਈ ਵਿੱਚ ਇੱਕ ਮਹਾਨ ਆਕਰਸ਼ਕ ਤਰਜ ਦੀ ਅਤੇ ਵਕਤ ਪਾਸ ਹੋਏ ਭਗਤ ਸਿੰਘ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਬਾਰੇ ਹੋਰ ਗਹਿਰਾਈ ਨਾਲ ਜਾਣਕਾਰੀ ਲੈਂਦੇ ਹਾਂ ਭਗਤ ਸਿੰਘ ਵਿੱ ਵੀ ਦੀ ਸੋਚ ਅਤੇ ਲਹਿਰਾਂ ਨੇ ਸਮਾਜਿਕ ਨਿਆਂ ਅਤੇ ਵਿਸ਼ਵਾਸਾਂ 'ਤੇ ਬਹੁਤ ਪ੍ਰਭਾਵ ਪਾਇਆ ਉਹ ਸਮਾਜਵਾਦੀ ਵਿਚਾਰਧਾਰਾ ਦੇ ਸਮਰਥਕ ਰਹੇ ਜਿਸ ਨੇ ਉਹਨਾਂ ਨੂੰ ਧੰਨਦਾਰਾਂ ਅਤੇ ਦਮਨਕਾਰੀ ਰਾਜ ਦੇ ਖਿਲਾਫ ਲੜਾਈ ਕਰਨ ਲਈ ਪ੍ਰੇਰਿਤ ਕੀਤਾ ਉਹ ਇਹ ਮੰਨਦੇ ਮੰਨਦੇ ਸਨ ਕਿ ਆਜ਼ਾਦੀ ਦੀ ਲੜਾਈ ਵਿੱਚ ਸਿਰਫ ਬ੍ਰਿਸਟ ਸਰਕਾਰ ਦੇ ਖਿਲਾਫ ਨਹੀਂ ਸਗੋਂ ਸਮਾਜਿਕ ਅਸਮਾਨਤਾ ਦੇ ਖਿਲਾਫ ਵੀ ਲੜਾਈ ਜ਼ਰੂਰੀ ਹੈ